ਜਿਵੇਂ ਕਿ ਤੁਸੀਂ ਪੁੱਛਿਆ ਪੇਂਡੂ ਪੰਜਾਬ ਵਿੱਚ ਗ੍ਰਾਮ ਪੰਚਾਇਤ ਦੀ ਕੀ ਭੂਮਿਕਾ ਹੁੰਦੀ ਹੈ ਕੀ ਹਰੇਕ ਪਿੰਡ ਵਿੱਚ ਇੱਕ ਗ੍ਰਾਮ ਪੰਚਾਇਤ ਹੁੰਦਾ ਜਿਹੜਾ ਪਿੰਡ ਦੇ ਝਗੜਿਆਂ ਦਾ ਲੜਾਈ ਝਗੜਿਆਂ ਦਾ ਫੈਸਲਾ ਕਰਦਾ ਪਿੰਡ ਦੀ ਆਈ ਮੀਨ ਜਿਹੜੀ ਸਾਫ਼ ਸਫਾਈ ਹੁੰਦੀ ਆ ਉਹਦਾ ਧਿਆਨ ਰੱਖਦਾ ਗਾ ਅਤੇ ਪਿੰਡ ਦੇ ਲੋਕਾਂ ਦਾ ਧਿਆਨ ਰੱਖਦਾ ਕਿ ਪਿੰਡ ਦੇ ਲੋਕਾਂ ਦਾ ਧਿਆਨ ਰੱਖਦਾ ਹੈ ਪਿੰਡ ਦੀਆਂ ਗਲੀਆਂ ਨਾਲੀਆਂ ਅਤੇ ਪਿੰਡ ਦਾ ਵਿਕਾਸ ਦੀ ਜਿਹੜੀ ਹੈਗੀ ਆ ਉਹ ਸਹਾਇਤਾ ਕਰਦਾ ਹੈ ਪਿੰਡ ਦੇ ਪਿੰਡ ਵਾਸਤੇ ਗਰਾਂਟ ਲੈਂਦਾ ਹੈਗਾ ਅਤੇ ਪਿੰਡ ਦੇ ਜਿਹੜਾ ਵਿਕਾਸ ਵਾਸਤੇ ਜੋ ਵੀ ਕੰਮ ਹੁੰਦਾ ਉਹਦਾ ਧਿਆਨ ਰੱਖਦਾ ਹੈਗਾ ਪਿੰਡ ਦੇ ਹਿੱਤ ਵਿੱਚ ਕੰਮ ਕਰਦਾ ਇਹ ਗ੍ਰਾਮ ਗ੍ਰਾਮ ਪੰਚਾਇਤ ਦਾ ਕੰਮ ਹੁੰਦਾ